ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਅ ਫਾਸਟ ਟਰੈਕ ਕੰਪਿਊਟਰ ਸੈਂਟਰ ਤੋਂ ਬੋਲ ਰਹੇ ਹਾਂ ਭਾਅ ਜੀ ਮੈਂ ਨਾ ਇੱਕ ਕੰਪਲੇਂਨ ਦੱਸਣੀ ਸੀ ਤੁਹਾਨੂੰ ਮੈਂ ਤੁਹਾਡੇ ਕੋਲੋਂ ਇੱਕ ਲੈਪਟੋਪ ਔਡਰ ਕੀਤਾ ਸੀਗਾ ਉਹਨੂੰ ਇੱਕ ਮਹੀਨੇ ਬਾਅਦ ਤਾਂ ਪਹਿਲਾਂ ਮੈਨੂੰ ਉਹਦੀ ਡਿਲੀਵਰੀ ਮਿਲੀ ਅਤੇ ਜਿਹੜਾ ਬੰਦਾ ਡਿਲੀਵਰ ਕਰਨ ਆਇਆ ਹੋਇਆ ਸੀ ਨਾ ਉਹਦਾ ਵਿਵਹਾਰ ਮੈਨੂੰ ਅੱਛਾ ਨਹੀਂ ਲੱਗਿਆ ਕਿਉਂਕਿ ਉਹ ਬਹੁਤ ਹੀ ਜ਼ਿਆਦਾ ਰੂਡ ਸੀ ਅਤੇ ਉਹਦੇ ਤੋਂ ਬਾਅਦ ਜਦੋਂ ਮੈਂ ਪੈ ਕੰਪਿ ਆਪਣਾ ਲੈਪਟੋਪ ਜਿਹੜਾ ਆ ਉਹਨੂੰ ਓਪਨ ਕੀਤਾ ਤਾਂ ਉਹਦੀ ਪੈਕਜਿੰਗ ਵੀ ਮੈਨੂੰ ਬਹੁਤ ਜ਼ਿਆਦਾ ਵਧੀਆ ਨਹੀਂ ਲੱਗੀ ਅਤੇ ਓਪਨ ਕਰਨ ਤੋਂ ਬਾਅਦ ਵੀ ਜਦੋਂ ਮੈਂ ਦੇਖਿਆ ਤਾਂ ਉਹ ਬਹੁਤ ਹੀ ਵਧੀਆ ਕੰਡੀਸ਼ਨ ਦੇ ਵਿੱਚ ਨਹੀਂ ਸੀ ਉਹਦੇ ਉੱਤੇ ਧੂੜ ਮਿੱਟੀ ਪਈ ਹੋਈ ਸੀਗੀ ਅਤੇ ਉਹਦੀ ਉਹਨੂੰ ਕਵਰ ਵੀ ਬਹੁਤ ਵਧੀਆ ਢੰਗ ਨਾਲ ਨਹੀਂ ਕੀਤਾ ਗਿਆ ਸੀਗਾ ਅਤੇ ਇਹਤੋਂ ਬਿਨਾਂ ਜਦੋਂ ਮੈਂ ਹੁਣ ਉਹਨੂੰ ਲੈਪਟੋਪ ਨੂੰ ਯੂਜ਼ ਕਰਦੀ ਹਾਂ ਤਾਂ ਵੀ ਮੈਨੂੰ ਉਹ ਬਹੁਤ ਵਧੀਆ ਨਤੀਜਾ ਨਹੀਂ ਦੇ ਰਿਹਾ ਕਿਉਂਕਿ ਇੱਕ ਤਾਂ ਉਹਦੀ ਬੈਟਰੀ ਬਹੁਤ ਜ਼ਿਆਦਾ ਨਹੀਂ ਚੱਲ ਰਹੀ ਆ ਅਤੇ ਹੁਣ ਮੈਨੂੰ ਚਾਰਜਿੰਗ 'ਤੇ ਲਗਾ ਕੇ ਹੀ ਉਹ ਉਹਨੂੰ ਯੂਜ਼ ਕਰਨਾ ਪੈਂਦਾ ਆ ਦੂਜੇ ਨੰਬਰ 'ਤੇ ਉਹਦੀ ਪ੍ਰੋਸੈਸਿੰਗ ਵੀ ਮੈਨੂੰ ਬਹੁਤ ਜ਼ਿਆਦਾ ਵਧੀਆ ਨਹੀਂ ਲੱਗੀ ਜਿੰਨੇ ਮੈਂ ਪੈਸੇ ਉਹਦੇ ਲਈ ਦਿੱਤੇ ਆ ਉਸ ਹਿਸਾਬ ਦੇ ਨਾਲ ਮੈਨੂੰ ਪ੍ਰੋਡਕਟ ਨਹੀਂ ਮਿਲਿਆ ਤਾਂ ਤੁਸੀਂ ਮੈਨੂੰ ਦੱਸੋ ਕਿ ਹੁਣ ਤੁਸੀਂ ਇਹਨੂੰ ਇਹਨਾਂ ਚੀਜ਼ਾਂ ਨੂੰ ਕਿੱਦਾਂ ਸਹੀ ਕਰੋਂਗੇ ਅਤੇ ਤੁਸੀਂ ਮੈਨੂੰ ਇਹ ਲੈਪਟੋਪ ਬਦਲ ਕੇ ਦਉਂਗੇ ਜਾਂ ਫਿਰ ਮੈਂ ਤੁਹਾਡੀ ਕੰਪਲੇਂਟ ਕਿਸੇ ਹੋਰ ਪਾਸੇ ਕਰਾਂ ਤਾਂ ਕਿ ਜੋ ਵੀ ਮੈਂ ਪੈਸੇ ਤੁਹਾਨੂੰ ਦਿੱਤੇ ਆ ਅ ਵਧੀਆ ਲੈਪਟੋਪ ਲੈਣ ਦੇ ਲਈ ਮੈਂ ਉਹਨਾਂ ਨੂੰ ਰਿਕਵਰ ਕਰ ਸਕਾਂ ਥੈਂਕ ਯੂ